ਇੱਕੀ ਸਤੰਬਰ ਉੱਨੀ ਅਠੱਤੀ ਅਠਾਰ੍ਹਾਂ ਮਈ ਵੀਹ ਵੀਹ ਅਠਾਈ ਜਨਵਰੀ ਵੀਹ ਦਸ ਉੱਨੀ ਮਾਰਚ ਵੀਹ ਬਾਈ ਅਠਾਈ ਜੂਨ ਵੀਹ ਚੌਵੀ